ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਹਾਂਜੀ

ਹਾਂਜੀ ਜਿਵੇਂ ਦੇਖੋ ਆਪਣੇ ਮਾਨਸਾ ਡਿਸਟਰਿਕ ਦੇ ਵਿੱਚ ਰੇਨੇਸੈਂਸ ਅਤੇ ਜੇ ਆਰ ਮਿਲੇਨੀਅਮ ਬੈਸਟ ਸਕੂਲਜ ਨੇ ਅਤੇ ਮੇਰੇ ਬੱਚੇ ਜੇ ਆਰ ਮਿਲੇਨੀਅਮ ਮਿਲੇਨੀਅਮ ਦੇ ਵਿੱਚ ਪੜ੍ਹ ਰਹੇ ਨੇ ਅਤੇ ਉਹਨਾਂ ਨੂੰ ਬਹੁਤ ਵਧੀਆ ਐਜੂਕੇਸ਼ਨ ਮਿਲ ਰਹੀ ਹੈ ਉੱਥੇ ਜਿਹੜਾ ਉਹਨਾਂ ਦਾ ਸਟਾਫ ਹੈ ਬਹੁਤ ਵਧੀਆ ਉਹਨਾਂ ਨੂੰ ਲਾਉਣ ਤੋਂ ਪਹਿਲਾਂ ਅਸੀਂ ਖੁਦ ਵਿਜਿਟ ਕਰਕੇ ਆਏ ਸੀ ਸਕੂਲ ਅਤੇ ਅਸੀਂ ਸਾਰਾ ਕੁਛ ਦੇਖ ਕੇ ਆਏ ਸੀਗੇ ਜਿਵੇਂ ਉਹਦੇ ਵਿੱਚ ਦਿੱਤਾ ਹੋਇਆ ਸੀ ਕਿ ਐਕਸਟਰਾ ਕਲਾਸ ਪ੍ਰੋਵਾਈਡ ਹੁੰਦੀਆਂ ਨੇ ਜਿਹੜੀਆਂ ਕਲਾਸਿਸ ਆ ਉਹ ਸਮਾਰਟ ਹੈ ਬੱਚਿਆਂ ਨੂੰ ਵੀਡੀਓ ਥਰੂ ਵੀ ਸਮਝਾਇਆ ਜਾਂਦਾ ਹੈ ਨਾ ਅਤੇ ਐਕਸਟਰਾ ਜੋ ਆ ਫਰੈਂਚ ਕਲਾਸਿਸ ਵੀ ਉਹ ਪ੍ਰੋਵਾਈਡ ਕਰਦੇ ਆ ਤਾਂ ਪਹਿਲਾਂ ਅਸੀਂ ਖੁਦ ਵਿਜਿਟ ਕੀਤਾ ਅਤੇ ਦੇਖਿਆ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਅਤੇ ਅਸੀਂ ਇਸ ਕਰਕੇ ਆਪਦੇ ਨੂੰ ਉੱਥੇ ਲਾਤਾ ਹਾਂਜੀ ਜੇ ਪੇਰੈਂਟਸ ਚਾਹੁੰਦੇ ਆ ਵੀ ਤੁਹਾਡੇ ਬੱਚੇ ਨੂੰ ਐਕਸਟਰਾ ਕਲਾਸ ਮਿਲੇ ਤਾਂ ਉਹ ਦੇ ਜਾਂਦੇ ਆ ਨਹੀਂ ਫਿਰ ਤਿੰਨ ਵਜੇ ਤੋਂ ਬਾਅਦ 'ਚੋਂ ਛੁੱਟੀ ਕਰ ਦਿੰਦੇ ਆ ਦੇਖੋ ਫੀਸ ਤਾਂ ਥੋੜ੍ਹੀ ਜਿਹੀ ਹਾਏ ਆ ਜਿਵੇਂ ਇੱਕ ਸਾਲ ਦਾ ਲੱਖ ਦੇ ਹਿਸਾਬ ਨਾਲ ਚੱਲ ਜਾਂਦਾ ਬਟ ਉੱਥੋਂ ਦੇ ਜਿਹੜੀ ਡਿਸਿਪਲਨ ਆ ਹੈ ਨਾ ਬੱਚਿਆਂ ਦੀ ਕੇਅਰ ਆ ਜਿਹੜੀਆਂ ਕੇਅਰਟੇਕਰਸ ਹੁੰਦੀਆਂ ਨੇ ਬਹੁਤ ਵਧੀਆ ਰੱਖਦੀਆਂ ਨੇ ਜਿਵੇਂ ਛੋਟੇ ਬੱਚੇ ਆ ਹੁਣ ਉਹਨਾਂ ਨੂੰ ਉਹ ਬਿਮਾਰ ਹੁੰਦੇ ਰਹਿੰਦੇ ਆ ਹੈ ਨਾ ਤਾਂ ਉਹਦੇ ਲਈ ਮੈਡੀਕਲ ਵੀ ਆ ਸਕੂਲ ਦੇ ਵਿੱਚ ਹੀ ਪ੍ਰੋਵਾਈਡ ਹੁੰਦਾ ਉਹਦੇ ਕੋਈ ਐਕਸਟਰਾ ਚਾਰਜ ਨਹੀਂ ਉਹ ਲੈਂਦੇ ਤੁਹਾਡੇ ਤੋਂ ਹਾਂਜੀ ਐਕਸਟਰਾ ਕਲਾਸ ਦਾ ਉਹ ਅਲੱਗ ਲੈਂਦੇ ਆ ਬਟ ਇਹ ਨਹੀਂ ਹੈਗਾ ਵੀ ਬਾਹਲਾ ਜ਼ਿਆਦਾ ਹਾਈ ਹੁੰਦਾ ਹੈਗਾ ਜਿਵੇਂ ਆਪਾਂ ਮਤਲਬ ਟਿਊਸ਼ਨ ਫੀਸ ਦਿੰਦੇ ਹਾਂ ਉਹ ਕਾਫੀ ਹਾਈ ਹੁੰਦੀ ਆ ਸੌ ਦੋ ਸੌ ਐਕਸਟਰਾ ਚਾਰਜ ਕਰਦੇ ਹੋਣਗੇ ਨਹੀਂ ਮੈੱਸ ਦਾ ਖਰਚਾ ਸਾਰਾ ਵਿੱਚ ਹੁੰਦਾ ਬਾਕੀ ਜੇ ਬੱਚਾ ਮਤਲਬ ਮੈੱਸ ਦੇ ਖਰਚੇ 'ਚੋਂ ਵੀ ਜ਼ਿਆਦਾ ਬਾਏ ਕਰ ਰਿਹਾ ਤਾਂ ਉਹ ਐਕਸਟਰਾ ਜ਼ਰੂਰ ਲੈਂਦੇ ਆ ਹਾਂਜੀ ਹਾਂਜੀ ਕੇਅਰਟੇਕਰਸ ਉੱਥੋਂ ਦੇ ਬਹੁਤ ਵਧੀਆ ਨੇ ਬਹੁਤ ਹੀ ਜ਼ਿਆਦਾ ਪੋਲਾਈਟ ਸਟਾਫ ਹੈ ਅਤੇ ਬਹੁਤ ਹੀ ਡਿਸਿਪਲਿਨ ਦਾ ਸਕੂਲ ਹਾਂਜੀ ਠੀਕ ਹੈ ਓਕੇ ਓਕੇ